ਸਤਿ ਸ਼੍ਰੀ ਅਕਾਲ ਭਾਅ ਜੀ ਹੋਰ ਜੀ ਕਿਆ ਹਾਲ ਚਾਲ ਹੈ ਜੀ ਹੋਰ ਸਭ ਵਧੀਆ ਜੀ ਰਮਨ ਏਜੰਸੀ ਤੋਂ ਬੋਲਦੇ ਭਾਅ ਜੀ ਮੈਨੂੰ ਭਾਅ ਜੀ ਤੁਹਾਡਾ ਨੰਬਰ ਮੇਰੇ ਦੋਸਤ ਨੇ ਦਿੱਤਾ ਸੀਗਾ ਸੁਖਚੈਨ ਨੇ ਉਹ ਮੇਰਾ ਗੁਆਂਢੀ ਹੈ ਉਹਨਾਂ ਨੇ ਮੈਂ ਉਹਨਾਂ ਨਾਲ ਗੱਲ ਕੀਤੀ ਸੀਗੀ ਵੀ ਦਿੱਲੀ ਜਾਣਾ ਮੈਂ ਕਾਰ 'ਚ ਤਾਂ ਉਨ੍ਹਾਂ ਨੇ ਮੈਨੂੰ ਤੁਹਾਡਾ ਰੈਕਮੈਂਡ ਕੀਤਾ ਸੀ ਤੁਹਾਡੇ ਬਾਰੇ ਦੱਸਿਆ ਸੀ ਵੀ ਵਧੀਆ ਸਰਵਿਸ ਹੈ ਵਧੀਆ ਸਰਵਿਸ ਪ੍ਰੋਵਾਇਡ ਕਰਦੇ ਹੈਗੇ ਆ ਉਹ ਮੈਨੂੰ ਅਤੇ ਮੈਂ ਰੋਪੜ ਤੋਂ ਦਿੱਲੀ ਜਾਣਾ ਚਾਹੁੰਦਾ ਏਂ ਮੇਰੇ ਬ੍ਰਦਰ ਦੀ ਕੱਲ ਦੀ ਫਲਾਈਟ ਹੈਗੀ ਹੈ ਰੋਪੜ ਉੱਥੇ ਦਿੱਲੀ ਤੋਂ ਕੈਨੇਡਾ ਦੀ ਸਵੇਰੇ ਗਿਆਰਾਂ ਵਜੇ ਦੀ ਹੈ ਤਾਂ ਆਪਾਂ ਤਾਂ ਜੋ ਉੱਥੇ ਆਪਾਂ ਟਾਈਮ ਨਾਲ ਪੁੱਜ ਸਕੀਏ ਅਤੇ ਤੁਹਾਨੂੰ ਪਤਾ ਹੈ ਭਾਅ ਜੀ ਰਸਤੇ 'ਚ ਟਰੈਫਿਕ ਵਗੈਰਾ ਵੀ ਕਾਫ਼ੀ ਹੁੰਦਾ ਹੈਗਾ ਹੈ ਕੱਲ੍ਹ ਨੂੰ ਮੌਸਮ ਵੀ ਖ਼ਰਾਬ ਦੱਸਿਆ ਹੋਇਆ ਹੈਗਾ ਹੈ ਅਤੇ ਉਹਦੇ ਕਰਕੇ ਆਪਾਂ ਚਾਹੁੰਦੇ ਹਾਂ ਕਿ ਆਪਾਂ ਟਾਇਮ ਨਾਲ ਪੁੱਜੀਏ ਅਤੇ ਸਾਡੇ ਨਾਲ ਸਾਡੇ ਫੈਮਲੀ ਮੈਂਬਰ ਜਿੱਦਾਂ ਸਾਡੇ ਬੱਚੇ ਹੋ ਗਏ ਮੰਮੀ ਡੈਡੀ ਹੋਊਂਗੇ ਅਤੇ ਉੱਧਰ ਬ੍ਰਦਰ ਦੀ ਵਾਈਫ ਜਾਊਂਗੀ ਨਾਲ ਅਤੇ ਉਹਦੇ ਤਾਂ ਜੋ ਆਪਾਂ ਸਾਨੂੰ ਤੁਸੀਂ ਸਾਨੂੰ ਘੁੰਮਾ ਫਿਰਾ ਕੇ ਵਧੀਆ ਦਿੱਲੀ ਅਤੇ ਟਾਇਮ ਨਾਲ ਪਹੁੰਚਾ ਦੂੰਗੇ ਅਤੇ ਆਪਣਾ ਭਾਅ ਜੀ ਤੁਸੀਂ ਕਿਰਾਇਆ ਦੱਸ ਦਿਉ ਭਾਅ ਜੀ ਕਿੰਨਾ ਵੀ ਹੋਇਆ ਧੰਨਵਾਦ ਭਾਅ ਜੀ